ਦਿਹਾਇਤੀ ਖੇਤਰਾਂ ਦੇ ਵਿੱਚ ਟੈਕਨੋਲੋਜੀ ਦੀਆਂ ਬਹੁਤ ਸਾਰੀਆਂ ਮ ਚੁਣੌਤੀਆਂ ਹਨ ਸਭ ਤੋਂ ਵੱਡੀ ਚੁਣੌਤੀ ਤਾਂ ਇੰਟਰਨੈਟ ਦੀ ਹੈ ਬਹੁਤ ਵਾਰੀ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਉਹਨਾਂ ਦੇ ਕੋਲ ਇੰਟਰਨੈਟ ਅ ਦੀ ਸੁਵਿਧਾ ਨਹੀਂ ਹੁੰਦੀ ਜਿਸ ਕਰਕੇ ਉਹ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਔਨਲਾਈਨ ਸ਼ੋਪਿੰਗ ਔਨਲਾਈਨ ਫੋਮਸ ਭਰਨ ਇਹ ਜਿਹੇ ਚੀਜ਼ਾਂ ਤੋਂ ਵੰਚਿਤ ਰਹਿ ਜਾਂਦੇ ਹਨ ਉਹਨਾਂ ਦੇ ਖੇ ਏਰੀਆਜ਼ ਦੇ ਵਿੱਚ ਪ੍ਰੋਪਰ ਨੈਟਵਰਕਿੰਗ ਹਜੇ ਨਹੀਂ ਹੋਈ ਉਹਨਾਂ ਦੇ ਕੋਲ ਪ੍ਰੋਪਰ ਮੋਬਾਈਲ ਫੋਨਸ ਨਹੀਂ ਹੈਗੇ ਜੇ ਕਿਸੇ ਨੇ ਕੋਈ ਔਨਲਾਈਨ ਫਾਰਮ ਭਰਨਾ ਤਾਂ ਉਹਨਾਂ ਨੂੰ ਸ਼ਹਿਰ ਆ ਕੇ ਫਾਰਮ ਭਰਨਾ ਪੈਂਦਾ ਹੈ ਜੇ ਕੋਈ ਉਹਨਾਂ ਨੇ ਇੰਟਰਨੈਟ ਬੈਂਕਿੰਗ ਯੂਜ ਕਰਨੀ ਹੈ ਜਾਂ ਕੋਈ ਔਨਲਾਈਨ ਸ਼ੋਪਿੰਗ ਕਰਨੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਬਾਰੇ ਉਹਨਾਂ ਨੂੰ ਕਈ ਵਾਰ ਨੋਲੇਜ ਵੀ ਨਹੀਂ ਹੁੰਦੀ ਉਹਨਾਂ ਨੂੰ ਆਪਣੇ ਓ ਟੀ ਪੀ ਵਗੈਰਾ ਬਾਰੇ ਵੀ ਨਹੀਂ ਪਤਾ ਹੁੰਦਾ ਕਿ ਓ ਟੀ ਪੀ ਨੂੰ ਕਿਸੇ ਦੇ ਨਾਲ ਸ਼ੇਅਰ ਕਰਨਾ ਕਿ ਨਹੀਂ ਕਰਨਾ ਉਹਨਾਂ ਨੂੰ ਅ ਟੈਕਨੋਲੋਜੀ ਈ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਜਿਹੜੀ ਔਨਲਾਈਨ ਸ਼ੋਪਿੰਗ ਹੈ ਉਹਦੇ ਕੀ ਪੋਜੀਟਿਵ ਅਤੇ ਕੀ ਨੈਗੇਟਿਵ ਨੇ ਉਹਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਉਹਨਾਂ ਨੇ ਜਦੋਂ ਆਪਣੇ ਨੈਟ ਬੈਂਕਿੰਗ ਯੂਜ ਕਰਨੀ ਹੈ ਤਾਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਨੇ